ਹੈਲੋ ਸਰ ਮੈਂ ਓਲਾ ਤੋਂ ਕੈਬ ਬੁੱਕ ਕਰਵਾਈ ਸੀ ਅਤੇ ਜਿਹੜੀ ਹੁਣ ਤੱਕ ਆਈ ਨਹੀਂ ਹੈ ਮੈਂ ਨੌ ਵੱਜ ਕੇ ਪਚਵੰਜਾ ਮਿੰਨਟ 'ਤੇ ਕੈਬ ਬੁੱਕ ਕਰਵਾਈ ਸੀ ਅਤੇ ਪਰ ਹੁਣ ਜਦ ਕਿ ਗਿਆਰ੍ਹਾਂ ਵੱਜ ਚੱਲੇ ਹਨ ਪਰ ਹਾਲੇ ਤੱਕ ਕੈਬ ਦਾ ਕੁਛ ਨਹੀਂ ਪਤਾ ਮੈਂ ਇਹ ਬੁਕਿੰਗ ਪ੍ਰੀ ਬੁੱਕ ਕਰਵਾਈ ਸੀ ਤਾਂ ਕਿ ਮੇਨੂੰ ਕੋਈ ਸਮੱਸਿਆ ਨਾ ਆ ਸਕੇ ਅਤੇ ਮੈਂ ਸਟੇਸ਼ਨ 'ਤੇ ਜਾਣਾ ਚਾਹੁੰਦੀ ਹਾਂ ਮੈਨੂੰ ਬਹੁਤ ਸਾਰੀ ਸਮੱਸਿਆ ਆ ਰਹੀ ਹੈ ਮੇਰੀ ਟਰੇਨ ਟਰੇਨ ਦਾ ਸਮੇਂ ਬਾਰ੍ਹਾਂ ਵਜੇ ਹੈ ਪਰ ਜਦ ਕਿ ਹਜੇ ਤੱਕ ਗਿਆਰ੍ਹਾਂ ਵਜੇ ਤੱਕ ਕੋਈ ਕੈਬ ਨਹੀਂ ਆਈ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹ ਕਦੋਂ ਤੱਕ ਆ ਜਾਏਗੀ ਜੇ ਜ਼ਿਆਦਾ ਸਮਾਂ ਲੱਗ ਰਿਹਾ ਹੈ ਤਾਂ ਮੈਂ ਦੁਬਾਰਾ ਤੋਂ ਕਿਸੇ ਹੋਰ ਤਰੀਕੇ ਨਾਲ ਉੱਥੇ ਸਟੇਸ਼ਨ 'ਤੇ ਪਹੁੰਚ ਸਕਾਂ ਜਾਂ ਦੁਬਾਰਾ ਤੋਂ ਕੈਬ ਬੁੱਕ ਕਰਵਾ ਸਕਾਂ ਤਾਂ ਕਿ ਮੇਰਾ ਸਮਾਂ ਵਿਅਸਤ ਵਿਅਰਥ ਨਾ ਜਾਵੇ ਅਤੇ ਮੈਂ ਸਮੇਂ 'ਤੇ ਪਹੁੰਚ ਕੇ ਸਟੇਸ਼ਨ 'ਤੇ ਆਪਣੀ ਟਰੇਨ ਨੂੰ ਫੜ ਸਕਾਂ ਉੱਥੇ ਮੈਨੂੰ ਜਾ ਕੇ ਆਪਣੀ ਮੀਟਿੰਗ ਅਟੈਂਡ ਕਰਨੀ ਹੈ ਜਿਹਦੇ ਕਰਕੇ ਮੈਂ ਇਸ ਟਰੇਨ ਨੂੰ ਮਿਸ ਨਹੀਂ ਕਰ ਸਕਦੀ ਅਤੇ ਆਪਣਾ ਸਮਾਂ ਬਿਲਕੁਲ ਵੀ ਬਰਬਾਦ ਨਹੀਂ ਕਰ ਸਕਦੀ ਕਿਰਪਾ ਕਰਕੇ ਮੈਨੂੰ ਦੱਸ ਦਿੱਤਾ ਜਾਵੇ ਕਿ ਮੇਰੀ ਜਿਹੜੀ ਕੈਬ ਜੋ ਮੈਂ ਪ੍ਰੀ ਬੁੱਕ ਕਰਵਾਈ ਸੀ ਜਦਕੀ ਪ੍ਰੀ ਬੁੱਕ ਦਾ ਇਹੀ ਮਤਲਬ ਹੁੰਦਾ ਹੈ ਕਿ ਕੈਬ ਸਾਨੂੰ ਸਮੇਂ ਸਿਰ ਮਿਲ ਸਕੇ ਅਤੇ ਅਸੀਂ ਸਮੇਂ ਤੋਂ ਸਮੇਂ ਆਪਣੇ ਨਿਸ਼ਚਿਤ ਜਗ੍ਹਾ 'ਤੇ ਜਾ ਕੇ ਆਪਣਾ ਕੰਮ ਕਰ ਸਕੀਏ ਪਰ ਪ੍ਰੀ ਬੁੱਕ ਕਰਵਾਉਣ ਦਾ ਮੈਨੂੰ ਤਾਂ ਕੁਛ ਵੀ ਲਾਭ ਨਹੀਂ ਮਿਲ ਰਿਹਾ ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਸਮੇਂ ਸਿਰ ਦੱਸ ਦਿੱਤਾ ਜਾਵੇ ਤਾਂ ਕਿ ਮੈਂ ਹੋਰ ਕੋਈ ਕੈਬ ਦਾ ਇੰਤਜ਼ਾਮ ਕਰ ਸਕਾਂ ਜਾਂ ਕਿਸੇ ਹੋਰ ਤਰੀਕੇ ਨਾਲ ਸਟੇਸ਼ਨ 'ਤੇ ਪਹੁੰਚ ਕੇ ਆਪਣਾ ਜਿਹੜਾ ਟਰੇਨ ਫੜ ਸਕਾਂ ਅਤੇ ਆਪਣੀ ਮੀਟਿੰਗ ਨੂੰ ਅਟੈਂਡ ਕਰ ਸਕਾਂ ਜੋ ਕਿ ਮੇਰੇ ਵਾਸਤੇ ਬਹੁਤ ਹੀ ਜ਼ਰੂਰੀ ਹੈ ਮੈਨੂੰ ਬਹੁਤ ਸਾਰੀ ਸਮੱਸਿਆ ਆ ਰਹੀ ਹੈ ਕਈ ਵਾਰ ਤਾਂ ਇੰਨੀ ਸਮੱਸਿਆ ਆ ਹੁਣ ਆ ਰਹੀ ਹੈ ਤਾਂ ਕਿ ਮੇਰਾ ਫੋਨ ਵੀ ਨਹੀਂ ਲੱਗ ਰਿਹਾ ਅਤੇ ਤੁਹਾਡੇ ਨਾਲ ਮੇਰੀ ਗੱਲ ਵੀ ਨਹੀਂ ਹੋ ਪਾ ਰਹੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਨੂੰ ਪਲੀਜ਼ ਜਾਂ ਐੱਸ ਐੱਮ ਐੱਸ ਜਾਂ ਫਿਰ ਕੋਲ ਕਰਕੇ ਦੱਸ ਦਿੱਤਾ ਜਾਵੇ ਕਿ ਜਿਹੜੀ ਕੈਬ ਹੈ ਉਹ ਕਿੰਨੀ ਦੇਰ ਤੱਕ ਮੇਰੇ ਕੋਲ ਪਹੁੰਚ ਜਾਏਗੀ ਜੇ ਜ਼ਿਆਦਾ ਟਾਈਮ ਲੱਗਣਾ ਹੈ ਤਾਂ ਮੈਂ ਕੋਈ ਹੋਰ ਇੰਤਜ਼ਾਮ ਕਰਕੇ ਸਟੇਸ਼ਨ 'ਤੇ ਪਹੁੰਚ ਸਕਾਂ ਧੰਨਵਾਦ